ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਰਹਿਣ ਲਈ ਕਮਰੇ ਵਗੈਰਾ ਕਾਫ਼ੀ ਨੇ ਅਤੇ ਸਰਾਂ ਵੀ ਹੈਗੀ ਰਹਿਣ ਲਈ ਰਹਿਣ ਦਾ ਪ੍ਰਬੰਧ ਕਾਫ਼ੀ ਜ਼ਿਆਦਾ ਖਾਣ ਪੀਣ ਦਾ ਵੀ ਹਾਂਜੀ ਇੱਥੇ ਲੰਗਰ ਵਿਵਸਥਾ ਚੌਵੀ ਘੰਟੇ

ਹਾਂਜੀ ਹਾਂਜੀ ਉਹਨਾਂ ਨੂੰ ਦੁੱਧ ਵਗੈਰਾ ਸਭ ਕੁਝ ਮਿਲੇਗਾ ਬੱਚਿਆਂ ਨੂੰ ਹਾਂਜੀ ਹਾਂਜੀ ਹਾਂਜੀ ਇੱਥੇ ਇਤਿਹਾਸ ਹੈਗਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸੀਗੇ ਵੱਡੇ ਚਮਕੌਰ ਸਾਹਿਬ ਸ਼ਹੀਦ ਹੋਏ ਸੀ ਅਤੇ ਜਿਹੜੇ ਛੋਟੇ ਛੋਟੇ ਸਾਹਿਬਜ਼ਾਦੇ ਸੀ ਇਹਨਾਂ ਨੂੰ ਸਰਹਿੰਦ ਵਾਲੇ ਸੂਬੇ ਨੇ ਜਿਸ ਤਰ੍ਹਾਂ ਧਰਮ ਮੁਸਲਿਮ ਮੰਨਣ ਲਈ ਕਿਹਾ ਸੀ ਉਹਨਾਂ ਨੇ ਹਾਰ ਨਾ ਮੰਨਦੇ ਹੋਏ ਇਹਨਾਂ ਨੂੰ ਮਤਲਬ ਇਹ ਕਹਿੰਦੇ ਵੀ ਅਸੀਂ ਹਾਰ ਨਹੀਂ ਮੰਨਣੀ ਹੈਗੀ ਆਪਣੇ ਧਰਮ ਨੂੰ ਨਹੀਂ ਮੁਸਲਮਾਨ ਨਹੀਂ ਬਣਨਾ ਹੈਗਾ ਸਿੱਖੀ ਧਰਮ ਨੂੰ ਨਹੀਂ ਛੱਡਣਾ ਉਸ ਲਈ ਉਹਨਾਂ ਨੇ ਸਰਹਿੰਦ ਸੂਬੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਵਾ ਤਾ ਸੀ ਉਹ ਭੋਰਾ ਵੱਡੇ ਗੁਰਦੁਆਰਾ ਸਾਹਿਬ ਦੇ ਨੀਚੇ ਭੋਰਾ ਸਾਹਿਬ ਸੁਸ਼ੋਭਿਤ ਆ ਕਲਗੀ ਪਾਲਕੀ ਸਾਹਿਬ ਆਪਣੇ ਅਤੇ ਉੱਥੇ ਉਹਨਾਂ ਨੂੰ ਨੀਹਾਂ ਵਿੱਚ ਚਿਣਵਾਇਆ ਸੀਗਾ ਹਾਂਜੀ ਇੱਕ ਉਹਨਾਂ ਦੇ ਸੰਸਕਾਰ ਹੋਏ ਸੀਗੇ ਆਪਣੇ ਜੋਤੀ ਸਰੂਪ ਗੁਰਦੁਆਰੇ 'ਚ ਅਤੇ ਆਪਣੇ ਟੋਡਰਮੱਲ ਜੀ ਨੇ ਜਿਹੜੀਆਂ ਮੋਹਰਾਂ ਸੀ ਉਹਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਮੋਹਰਾਂ ਦੇ ਕੇ ਉਹ ਜਗ੍ਹਾ ਖਰੀਦ ਕੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ ਅਤੇ ਇੱਕ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਰਾਤ ਗੁਜ਼ਾਰੀ ਸੀ ਉਹ ਮਾਤਾ ਗੁਜਰ ਕੌਰ ਜੀ ਦਾ ਹੈਗਾ ਗੁਰਦੁਆਰਾ ਸਾਹਿਬ ਵੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਓਕੇ ਜੀ ਓਕੇ